ਹੈਲੋ ਮੇਰਾ ਨਾਮ ਕਰਮਜੀਤ ਸਿੰਘ ਹੈ ਅਤੇ ਮੈਂ ਤੁਹਾਡੀ ਕੈਬ ਬੁੱਕ ਕੀਤੀ ਸੀ ਜਿਸ ਜਿਸ ਲਈ ਕਿ ਮੈਂ ਤੁਹਾਨੂੰ ਆਪਣੀ ਕਰੰਟ ਲੋਕੇਸ਼ਨ ਵੀ ਭੇਜੀ ਸੀ ਪਰ ਮੈਨੂੰ ਇੱਕ ਜ਼ਰੂਰੀ ਕੰਮ ਪੈ ਗਿਆ ਸੀ ਜਿਸ ਕਰਕੇ ਹੁਣ ਮੇਰੀ ਕਰੰਟ ਲੋਕੇਸ਼ਨ ਚੇਂਜ ਹੋ ਗਈ ਹੈ ਅਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਜੋ ਮੈਂ ਜੋ ਤੁਹਾਨੂੰ ਪਹਿਲਾਂ ਆਪਣੀ ਲੋਕੇਸ਼ਨ ਭੇਜੀ ਸੀ ਉਸ ਦੀ ਬਜਾਏ ਮੈਨੂੰ ਹੁਣ ਵਾਲ਼ੀ ਕਰੰਟ ਲੋਕੇਸ਼ਨ ਤੋਂ ਪਿੱਕ ਕੀਤਾ ਜਾਵੇ ਮੈਂ ਤੁਹਾਨੂੰ ਆਪਣੀ ਲੋਕੇਸ਼ਨ ਭੇਜ ਦਿੱਤੀ ਹੈ ਸੋ ਕਿਰਪਾ ਕਰਕੇ ਮੈਨੂੰ ਹੁਣ ਵਾਲੀ ਲੋਕੇਸ਼ਨ ਤੋਂ ਪਿੱਕ ਕੀਤਾ ਜਾਵੇ ਧੰਨਵਾਦ